ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਆਪ ਕੌਣ ਅੱਛਾ ਤੁਸੀਂ ਗੁਰ ਗੁਰਪ੍ਰੀਤ ਦੀ ਮੰਮੀ ਬੋਲਦੇ ਪਏ ਹੋ ਹਾਂਜੀ ਹਾਂਜੀ ਜੀ ਕੀ ਕੰਮ ਹੋ ਗਿਆ ਦਸ ਦਿਨ ਦੀ ਛੁੱਟੀਆਂ ਉਹਨੇ ਤਾਂ ਅੱਗੇ ਬੜੀ ਛੁੱਟੀਆਂ ਕੀਤੀਆਂ ਉਹਨੂੰ ਮੈਂ ਦਸ ਦਿਨ ਦੀ ਛੁੱਟੀਆ ਕਿਵੇਂ ਦੇਦਾਂ ਪਰ ਜੇ ਮੈਂ ਉਹਨੂੰ ਛੁੱਟੀਆਂ ਦੇਤੀ ਤਾਂ ਉਹਦੀ ਤਾਂ ਅਟੈਂਡੈਂਸ ਨਹੀਂ ਪੂਰੀ ਹੋਣਾ ਨਾ ਹੀ ਸਿਲੇਬਸ ਹੋਣਾ ਆ ਤਾਂ ਉਹਨੇ ਪੇਪਰਾਂ 'ਚ ਕਿੱਦਾਂ ਪਾਸ ਹੋਣਾ ਨਹੀਂ ਨਹੀਂ ਜੇ ਉਹ ਫੇਲ ਵਗੈਰਾ ਹੋ ਗਿਆ ਫਿਰ ਤਾਂ ਤੁਸੀਂ ਸਾਨੂੰ ਬਲੇਮ ਕਰਨਾ ਕਿ ਤੁਸੀਂ ਪੜ੍ਹਾਇਆ ਨਹੀਂ ਹੈ ਯੇ ਵੋ ਕਿਉਂਕਿ ਕਈ ਮਾਂ ਪਿਓ ਇੱਦਾਂ ਹੀ ਕਰਦੇ ਆ ਨਹੀਂ ਨਹੀਂ ਜਿੱਦਾਂ ਦੇਖੋ ਉਹ ਹੈ ਜੇ ਕੋਈ ਹੋਰ ਹੋਵੇਗਾ ਫਿਰ ਮੈਂ ਕੀ ਕਰਾਂਗਾ ਚੱਲੋ ਠੀਕ ਹੈ ਮੈਂ ਦੇਖਾਂਗਾ ਠੀਕ ਹੈ ਬਾਏ ਓਕੇ